ਜਦ ਮੈਨੂੰ ਪਹਿਲੀ ਵਾਰ ਖਾਣਾ ਬਣਾਉਣਾ ਪਿਆ ਸਾਡੇ ਘਰ ਵਿੱਚ ਕੋਈ ਨਹੀਂ ਸੀ ਅਤੇ ਮੈਨੂੰ ਕੁਛ ਵੀ ਬਣਾਉਣਾ ਨਹੀਂ ਆਉਂਦਾ ਇਸ ਲਈ ਮੈਂ ਟਰਾਈ ਕਰਨੀ ਪਹਿਲਾਂ ਦਾਲ ਦਾਲ ਚੌਲ ਬਣਾਉਣ ਦਾ ਹੀ ਸੋਚਿਆ ਪਹਿਲਾਂ ਦਾਲ ਲਈ ਦਾਲ ਨੂੰ ਧੋਤਾ ਧੋ ਕੇ ਤਿੰਨ ਵਾਰੀ ਧੋ ਕੇ ਉਹਦੇ ਵਿੱਚ ਪਾਣੀ ਕੁੱਕਰ ਵਿੱਚ ਪਾਣੀ ਪਾ ਕੇ ਗੈਸ 'ਤੇ ਉਹਨੂੰ ਪਾਣੀ ਗਰਮ ਵਾਸਤੇ ਰੱਖ ਦਿੱਤਾ ਉਹਦੇ ਵਿੱਚ ਦਾਲ ਚਣਿਆਂ ਦੀ ਮਹਾਂਵਾਂ ਦੀ ਲੈ ਕੇ ਥੋੜ੍ਹੇ ਜਿਹੇ ਰਾਜਮਾਂਹ ਪਾ ਲਏ ਉਨ੍ਹਾਂ ਨੂੰ ਉਹਦੇ ਵਿੱਚ ਰੱਖ ਤਾ ਕੁੱਕਰ ਵਿੱਚ ਪਾ ਕੇ ਹਲਦੀ ਨਮਕ ਥੋੜ੍ਹਾ ਜਿਹਾ ਤੇਲ ਪਾ ਕੇ ਉਹਨੂੰ ਗੈਸ ਨੂੰ ਚਲਾ ਕੇ ਉਹਦੇ ਵਿੱਚ ਵਿਸਲ ਵੱਜਣ ਨੂੰ ਰੱਖ ਦਿੱਤੇ ਜਦੋਂ ਸ ਅੱਠ ਸੱਤ ਅੱਠ ਵਿਸਲਾਂ ਵੱਜ ਗਈਆਂ ਉਸ ਤੋਂ ਬਾਅਦ ਗੈਸ ਬੰਦ ਕੀਤਾ ਲਸਣ ਛਿੱਲਿਆ ਪਿਆਜ਼ ਚੀਰਿਆ ਇੱਕ ਪਾਸੇ ਤੇਲ ਰੱਖ ਕੇ ਥੋੜ੍ਹਾ ਜਿਹਾ ਜੀਰਾ ਜੁਆਇਨ ਦਾ ਤੜਕਾ ਲਾਇਆ ਫਿਰ ਥੋੜ੍ਹਾ ਜਿਹਾ ਲਸਣ ਪਾਇਆ ਲਸਣ ਨੂੰ ਫਰਾਈ ਕਰਕੇ ਉਹਦੇ ਵਿੱਚ ਪਿਆਜ਼ ਟਮ ਪਿਆਜ਼ ਪਾ ਕੇ ਥੋੜ੍ਹਾ ਜਿਹਾ ਉਹਨੂੰ ਰ ਸੇਕ ਲਗਵਾਇਆ ਉਹਦੇ ਵਿੱਚ ਹਲ ਥੋੜ੍ਹਾ ਜਿਹਾ ਹਲਦੀ ਮਸਾਲੇ ਨਮਕ ਅਤੇ ਥੋੜ੍ਹੀ ਸਜਾਵਟ ਵਾਸਤੇ ਦੇਗੀ ਮਿਰਚ ਪਾਈ ਉਸ ਤੋਂ ਬਾਅਦ ਮੈਂ ਉਹਨੂੰ ਦਾਲ ਨੂੰ ਉਹਦੇ ਤੜਕੇ ਨੂੰ ਦਾਲ ਦੇ ਵਿੱਚ ਫਰਾਈ ਕਰ ਦਿੱਤਾ ਥੋੜ੍ਹਾ ਬਾਅਦ ਵਿੱਚ ਸੇਕ ਲਵਾ ਕੇ ਦਾਲ ਵਿੱਚ ਪਾ ਦਿੱਤਾ ਉਸ ਤੋਂ ਬਾਅਦ ਮੈਂ ਫਿਰ ਤੋਂ ਚੌਲ ਬਣਾਏ ਚੌਲ ਲਈ ਪਹਿਲਾਂ ਮੈਂ ਪਾਣੀ ਰੱਖਿਆ ਫਿਰ ਚੌਲ ਲਏ ਧੋਤੇ ਫਿਰ ਪਾਣੀ ਕਰਕੇ ਫਿਰ ਉਹਨੂੰ ਇੱਕ ਵਿਸਲ ਵਜਾਈ ਅਤੇ ਚੌਲ ਰੈਡੀ ਹੋ ਗਏ ਉਸ ਤੋਂ ਬਾਅਦ ਮੈਂ ਹੁਣ ਕੋਈ ਵੀ ਡਿਸ਼ ਹੋਏ ਕਿਸੇ ਵੀ ਤਰ੍ਹਾਂ ਦੀ ਸਭ ਕੁਛ ਬਣਾ ਲੈਂਦੀ ਹਾਂ ਕਿਸੇ ਤਰ੍ਹਾਂ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਇਦ ਇਸ ਕੱਲ੍ਹ ਮੈਂ ਇੰਨਾਂ ਸਵਾਦ ਖਾਣਾ ਬਣਾਉਂਦੀ ਹਾਂ ਕਿ ਸਾਰੇ ਉਂਗਲੀਆਂ ਚੱਟਦੇ ਰਹਿ ਜਾਂਦੇ ਹੈ